ਹੈਲੋ ਤੁਸੀਂ ਓਲਾ ਕੈਬ ਤੋਂ ਬੋਲਦੇ ਪਏ ਹੋ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਮੈਡੀਕਲ ਇੰਨਕਲੇਵ ਤੋਂ ਲੈ ਕੇ ਹ ਹਰਿਮੰਦਰ ਸਾਹਿਬ ਜਾਣ ਲਈ ਓਲਾ ਕੈਬ ਦਾ ਤੁਹਾਡਾ ਬੁੱਕ ਕਰਵਾਈ ਸੀ ਉਸ ਵਿੱਚ ਡਰਾਈਵਰ ਸੀ ਰਾਮ ਸਿੰਘ ਰਾਮ ਸਿੰਘ ਡਰਾਈਵਰ ਬਹੁਤ ਹੀ ਚੰਗਾ ਸੀ ਅਤੇ ਤੁਸੀਂ ਮੈਨੂੰ ਹੁਣ ਦੁਬਾਰਾ ਤੋਂ ਹੀ ਮੈਂ ਉਹਨੂੰ ਹੀ ਬੁੱਕ ਕਰਨਾ ਚਾਹੁੰਦੀ ਹਾਂ ਮੈਂ ਤਾਂ ਫਿਰ ਦੁਬਾਰਾ ਤੋਂ ਗੁ ਹਰਿਮੰਦਰ ਸਾਹਿਬ ਜਾਣਾ ਚਾਹੁੰਦੀ ਹਾਂ ਅਤੇ ਪਰਸੋਂ ਜਾਣਾ ਚਾਹੁੰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਹੀ ਜਿਹੜੇ ਬੰਦੇ ਰਾਮ ਸਿੰਘ ਸੀ ਜਿਹੜੇ ਮੈਨੂੰ ਲੈ ਕੇ ਗਏ ਸੀ ਉਹ ਹੀ ਦੁਬਾਰਾ ਤੋਂ ਮੈਨੂੰ ਬੁੱਕ ਕਰਵਾ ਦਿਓ ਮੈਂ ਕਿਉਂਕਿ ਉਹ ਬੰਦੇ ਇੰਨੇ ਹੀ ਰਾਮ ਸਿੰਘ ਜੀ ਇੰਨੇ ਚੰਗੇ ਡਰਾਈਵਰ ਸੀ ਕਿ ਉਹਨਾਂ ਨੇ ਹਰ ਗੱਲੇ ਮੇਰੇ ਨਾਲ ਮੇਰੀ ਮਦਦ ਕੀਤੀ ਕਿਉਂਕਿ ਇੱਕ ਤਾਂ ਰਸ਼ ਬਹੁਤ ਜ਼ਿਆਦਾ ਮਿਲਿਆ ਅਤੇ ਉਹਨਾਂ ਨੇ ਆਰਾਮ ਨਾਲ ਗੱਡੀ ਵੀ ਆਰਾਮ ਨਾਲ ਚਲਾਈ ਸੀ ਜਿਹਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਅਤੇ ਉਹ ਬੰਦਾ ਇੰਨਾ ਕੁ ਵਧੀਆ ਸੀ ਜਿਹਦੇ ਨਾਲ ਮੈਂ ਚਾਹੁੰਦੀ ਹਾਂ ਕਿ ਹੁਣ ਵੀ ਜੇ ਮੈਂ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜਾਵਾਂਗੀ ਤਾਂ ਉਹ ਹੀ ਮੇਰੇ ਨਾਲ ਚੱਲਣਗੇ ਕਿਉਂਕਿ ਉਹ ਬੰਦੇ ਉਸ ਉਸ ਆਦਮੀ ਨੇ ਮੇਰੀ ਬਹੁਤ ਹੀ ਜਗ੍ਹਾ 'ਤੇ ਮਦਦ ਕੀਤੀ ਇੱਕ ਵਾਰੀ ਮੇਰਾ ਜ ਪਰਸ ਵੀ ਜ਼ਮੀਨ ਦੇ ਉੱਤੇ ਉਹਦੀ ਗੱਡੀ ਵਿੱਚ ਡਿੱਗ ਪਿਆ ਸੀ ਅਤੇ ਉਹ ਬੰਦੇ ਨੇ ਥੋੜ੍ਹੇ ਦੇਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਮੇਰਾ ਜਿਹੜਾ ਪਰਸ ਹੈਗਾ ਉਹ ਉਹਨਾਂ ਦੀ ਗੱਡੀ ਵਿੱਚ ਡਿੱਗ ਪਿਆ ਹੈ ਅਤੇ ਜਦੋਂ ਮੈਂ ਉਤਰੀ ਅਤੇ ਥੋੜ੍ਹੀ ਜਿਹੀ ਦੂਰ ਗਈ ਤਾਂ ਮੇਰਾ ਪਰਸ 'ਚ ਨਹੀਂ ਸੀ ਲੱਗਾ ਅਤੇ ਫਿਰ ਉਹ ਵਿਚਾਰਾ ਬੰਦਾ ਮੈਨੂੰ ਉਥੋਂ ਰੋਕ ਕੇ ਦਵਾ ਦਵ ਮੇਰੇ ਕੋਲ ਆਇਆ ਕਿ ਮੈਂ ਮੈਡਮ ਜੀ ਤੁਹਾਡਾ ਪਰਸ ਪਿਛਲੀ ਗੱਡੀ ਦੇ ਵਿੱਚ ਡਿੱਗ ਪਿਆ ਹੋਇਆ ਸੀ ਪਿੱਛੇ ਜਿੱਥੇ ਤੁਸੀਂ ਬੈਠੇ ਹੋਏ ਸਨ ਇੰਨਾ ਇਮਾਨਦਾਰ ਅਤੇ ਚੰਗਾ ਬੰਦਾ ਮੈਂ ਕਦੇ ਵੀ ਨਹੀਂ ਦੇਖਿਆ ਹੈ ਇਸ ਕਰਕੇ ਜੇ ਮੈਂ ਹੁਣ ਸੋਚਦੀ ਹਾਂ ਕਿ ਜੇ ਮੈਂ ਹੁਣ ਹਰਿਮੰਦਰ ਸਾਹਿਬ ਜਾਵਾਂਗੀ ਤਾਂ ਮੈਂ ਓਲਾ ਗੱਡੀ ਹੀ ਬੁੱਕ ਕਰਾਵਾਂਗੀ ਤਾਂ ਕਿਰਪਾ ਕਰਕੇ ਮੈਨੂੰ ਰਾਮ ਸਿੰਘ ਜੀ ਦੇ ਨਾਲ ਹੀ ਭੇਜਣਾ ਕਿਉਂਕਿ ਉਹਨਾਂ ਜਿੰਨਾ ਚੰਗਾ ਡਰਾਈਵਰ ਹੋਰ ਕਿਤੇ ਵੀ ਨਹੀਂ ਮੈਂ ਦੇਖਿਆ ਅੱਜ ਕੱਲ੍ਹ ਦੇ ਲੋਕ ਇੰਨੇ ਕੁ ਜ਼ਿਆਦਾ ਚੋਰ ਹੋ ਚੁੱਕੇ ਹਨ ਹਰ ਜਗ੍ਹਾ ਹੱਥ ਪਤ ਹੱਥ 'ਤੇ ਹੱਥ ਮਾਰ ਕੇ ਲੋਕਾਂ ਦੀਆਂ ਚੈਨਾਂ ਲੋਕਾਂ ਦੇ ਪਰਸ ਖੋਹ ਲੈਂਦੇ ਹਨ ਪਰ ਰਾਮ ਸਿੰਘ ਜੀ ਇੰਨੇ ਚੰਗੇ ਡਰਾਈਵਰ ਸਨ ਕਿ ਉਹਨਾਂ ਨੇ ਮੇਰੇ ਡਿੱਗੇ ਹੋਏ ਪਰਸ ਨੂੰ ਵੀ ਚੁੱਕ ਕੇ ਅਤੇ ਮੈਨੂੰ ਦੇ ਦਿੱਤਾ ਅਤੇ ਨਾਲ ਉਹ ਬੋਲਦੇ ਵੀ ਬਹੁਤ ਹੀ ਚੰਗਾ ਸੀ ਉਹਨਾਂ ਨੇ ਮੈਡਮ ਜੀ ਮੈਡਮ ਜੀ ਕਰਕੇ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਨਾਲ ਆਪਣੀ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਨਾਲ ਉਹ ਮੈਂ ਜਿੱਥੋਂ ਤੱਕ ਮੈਂ ਦੇਖਿਆ ਕਈ ਲੋਕ ਡਰਾਈਵਰਾਂ ਦੀ ਨਿਗ੍ਹਾ ਬੜੀ ਗੰਦੀ ਹੁੰਦੀ ਉਹ ਬਹੁਤ ਹੀ ਚੰਗੇ ਸੀ ਇਸ ਕਰਕੇ ਜੇ ਮੈਨੂੰ ਹੁਣ ਤੁਸੀਂ ਓਲਾ ਗੱਡੀ ਬੁੱਕ ਕਰਾਓਗੇ ਤਾਂ ਕੱਲ੍ਹ ਲਈ ਮੈਨੂੰ ਉਹਨਾਂ ਨਾਲ ਹੀ ਭੇਜ ਦੇਣਾ